ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੀ ਭਾਸ਼ਾ ਦੀ ਗੱਲ ਕਰੀਏ ਸੱਭਿਆਚਾਰਕ ਦੀ ਗੱਲ ਕਰਦੇ ਹਾਂ ਤਾਂ ਰੀਤੀ ਰਿਵਾਜ਼ ਇਹਦੇ ਵਿੱਚ ਸੱਭਿਆਚਾਰਕ ਤਾਂ ਓਹੀ ਗਿੱਧਾ ਭੰਗੜਾ ਕਿੱਕਲੀ ਆਮ ਹੀ ਚੱਲਦੀ ਆ ਦੋ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੱਲਦੀ ਆ ਇੱਥੋਂ ਦੇ ਰੀਤੀ ਰਿਵਾਜ਼ ਰੀਤੀ ਰਿਵਾਜ਼ਾਂ ਦਾ ਵੀ ਥੋੜ੍ਹਾ ਜਿਹਾ ਡਿਸ ਫਰਕ ਆ ਭਾਸ਼ਾ ਦਾ ਬਹੁਤ ਜ਼ਿਆਦਾ ਫਰਕ ਹੈਗਾ ਜਿਵੇਂ ਕਿ ਹਮੇ ਤੁਮੇ ਇਹ ਭਾਸ਼ਾਵਾਂ ਬੋਲ਼ੀਆਂ ਜਾਂਦੀਆਂ ਨੇ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਇਹ ਭਾਸ਼ਾਵਾਂ ਦੇ ਵਿੱਚ ਬੋਲ਼ਿਆ ਗਿਆ ਹੈਗਾ